ਇੱਕ ਵਾਰ ਸਾਡੇ ਸਕੂਲ ਵਿੱਚ ਇੱਕ ਮੇਲਾ ਲਗਾਇਆ ਗਿਆ ਜਿਸ ਵਿੱਚ ਸਾਰੇ ਕਲਾਸਾਂ ਜਮਾਤਾਂ ਦੇ ਵਿਦਿਆਰਥੀਆਂ ਨੇ ਕੁਛ ਨਾ ਕੁਛ ਤਿਆਰ ਕਰਨਾ ਸੀ ਉਹ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੋ ਸਕਦਾ ਸੀ ਚਾਹੇ ਵਿਗਿਆਨ ਨਾਲ ਸੰਬੰਧਿਤ ਇਤਿਹਾਸ ਨਾਲ ਸੰਬੰਧਿਤ ਅਤੇ ਵਪਾਰ ਨਾਲ ਸੰਬੰਧਿਤ ਕੁਛ ਵੀ ਹੋ ਸਕਦਾ ਸੀ ਇਸ ਵਿੱਚ ਮੈਂ ਸਾਡੀ ਕਲਾਸ ਨੇ ਇੱਕ ਵਪਾਰਕ ਦ੍ਰਿਸ਼ ਪੇਸ਼ ਕੀਤਾ ਸੀ ਜੋ ਕਿ ਸਾਡੇ ਲਈ ਕਰਨਾ ਬਹੁਤ ਹੀ ਔਖਾ ਰਿਹਾ ਸੀ ਕਿਉਂਕਿ ਸਾਡੇ ਕੋਲ਼ ਟਾਈਮ ਵੀ ਬਹੁਤ ਘੱਟ ਸੀ ਅਤੇ ਉਸ ਸਮੇਂ ਸਾਡਾ ਟੀਚਰ ਵੀ ਐਬਸੈਂਟ ਰਹਿੰਦਾ ਸੀ ਅਤੇ ਸਾਨੂੰ ਕਿਸੇ ਚੀਜ਼ ਬਾਰੇ ਵੀ ਗਿਆਨ ਨਹੀਂ ਸੀ ਇਸ ਲਈ ਸਾਡੇ ਲਈ ਬਹੁਤ ਹੀ ਔਖਾ ਹੋ ਰਿਹਾ ਸੀ ਅਸੀਂ ਕਲਾਸ ਵਿੱਚ ਵੀ ਦੋ ਹੀ ਕੁੜੀਆਂ ਸਨ ਇਸ ਲਈ ਇਹ ਮੌਕੇ ਇਹ ਚੁਣੌਤੀ ਨੂੰ ਸਾਂਭਣਾ ਬਹੁਤ ਹੀ ਔਖਾ ਹੋ ਰਿਹਾ ਸੀ ਪਰ ਫਿਰ ਵੀ ਅਸੀਂ ਆਪਣੇ ਪੂਰੀ ਜੀ ਜਾਨ ਨਾਲ ਮਿਹਨਤ ਕੀਤੀ ਅਤੇ ਇਸ ਅਤੇ ਇੰਟਰਨੈੱਟ 'ਤੇ ਇਸ ਵਿਸ਼ੇ ਨਾਲ ਸੰਬੰਧਿਤ ਬਹੁਤ ਹੀ ਸਰਚ ਕੀਤੀ ਅਤੇ ਸਾਨੂੰ ਬਹੁਤ ਹੀ ਗਿਆਨ ਮਿਲਿਆ ਅਤੇ ਇਸ ਗਿਆਨ ਨੂੰ ਅਸੀਂ ਆਪਣੇ ਪ੍ਰੋਜੈਕਟ ਵਿੱਚ ਸ਼ਾਮਿਲ ਕੀਤਾ ਅਤੇ ਪ੍ਰੋਜੈਕਟ ਤੋਂ ਬਾਅਦ ਜਦੋਂ ਡਾਇਰੈਕਟਰ ਸਾਹਿਬ ਨੇ ਸਾਡਾ ਪ੍ਰੋਜੈਕਟ ਦੇਖਿਆ ਅਤੇ ਜਿਸ ਤਰੀਕੇ ਨਾਲ ਅਸੀਂ ਆਪਣੇ ਪ੍ਰੋਜੈਕਟ ਨੂੰ ਪੇਸ਼ ਕੀਤਾ ਮਤਲਬ ਉਨ੍ਹਾਂ ਨੂੰ ਸਮਝਾਇਆ ਉਨ੍ਹਾਂ ਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਇਸ ਲਈ ਸਾਡੇ ਕਲਾਸ ਨੂੰ ਪਹਿਲਾ ਇਨਾਮ ਦਿੱਤਾ ਗਿਆ ਜੋ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਸੀ ਸਾਨੂੰ ਖੁਸ਼ੀ ਸੀ ਅਸੀਂ ਇਸ ਚੁਣੌਤੀ ਨੂੰ ਸੰਭਾਲਿਆ ਅਤੇ ਅਤੇ ਆਪਣਾ ਟਾਰਗੇਟ ਪੂਰਾ ਕਰ ਦਿਖਾਇਆ